ਬੂੰਦੀ ਲੱਡੂ ਬਰਫੀ ਵੇਸਣ ਦੀ ਬਰਫੀ ਓ ਗੁਲਾਬ ਜਾਮਣ ਰਸਗੁੱਲੇ ਪੇੜੀਆਂ ਜਲੇਬੀਆਂ ਖੁਰਮੇ ਓ ਅਮ੍ਰਤੀ ਅਤੇ ਓ ਬਾਲੂਸ਼ਾਹੀ ਉਹ ਵੀ ਹੁੰਦੇ ਨੇ ਤੋ